ਸਤਿ ਸ਼੍ਰੀ ਅਕਾਲ ਸਰ ਮੈਂ ਨਾ ਪੰਦਰ੍ਹਾਂ ਦਿਨ ਪਹਿਲਾਂ ਤੁਹਾਡੇ ਤੁਹਾਡੀ ਇਹ ਐਪ ਤੋਂ ਮੈਂ ਬੁੱਕ ਕਰਵਾਏ ਸੀਗੇ ਪਲਾਸਟਿਕ ਦੇ ਕੰਟੇਨਰ ਸੋ ਕੱਲ੍ਹ ਮੇਰੇ ਕੋਲ ਪਹੁੰਚੇ ਆ ਅਤੇ ਜਦੋਂ ਮੈਂ ਉਹ ਪੈਕਿੰਗ ਖੋਲ੍ਹੀ ਏ ਤਾਂ ਬੜਾ ਮਨ ਦੁਖੀ ਹੋਇਆ ਕਿਉਂਕਿ ਉਹ ਬੜੀ ਘਟੀਆ ਜਿਹੀ ਪੈਕਿੰਗ ਸੀ ਫਟੀ ਮਤਲਬ ਜਿਹੜੇ ਕੰਟੇਨਰ ਨਿਕਲੇ ਨੇ ਵਿੱਚੋਂ ਪਲਾਸਟਿਕ ਦੇ ਉਹ ਵੀ ਜਿਵੇਂ ਬਹੁਤ ਪੁਰਾਣੇ ਕੋਈ ਪਏ ਹੋਣ ਔਰ ਮੈਟੀਰੀਅਲ ਬੜਾ ਉਹਨਾਂ ਦਾ ਘਟੀਆ ਜਿਹਾ ਸੀ ਪਲਾਸਟਿਕ ਬੜੀ ਪਤਲੀ ਜੀ ਹੈ ਨਾ ਜਿਵੇਂ ਅਤੇ ਉਹਨਾਂ ਦੇ ਢੱਕਣ ਵੀ ਪ੍ਰੋਪਰ ਨਹੀਂ ਲੱਗ ਰਹੇ ਹੈ ਨਾ ਮੈਂ ਏਅਰ ਟਾਈਟ ਕਰਕੇ ਮੰਗਵਾਏ ਸੀਗੇ ਤਾਂ ਉਹਦੇ 'ਤੇ ਤਾਂ ਏਅਰ ਟਾਈਟ ਵਾਲੀ ਗੱਲ ਹੁਣ ਆਏਗੀ ਨਹੀਂ ਕਿਉਂਕਿ ਢੱਕਣ ਨਹੀਂ ਲੱਗ ਰਹੇ ਦੂਜਾ ਮੈਂ ਜਿਹੜੇ ਪ੍ਰਿੰਟਡ ਮੰਗਵਾਏ ਸੀਗੇ ਉਹ ਤਾਂ ਤੁਹਾਡੇ ਉਹ ਤੁਸੀਂ ਬਿਲਕੁਲ ਪਲੇਨ ਹੀ ਭੇਜ ਦਿੱਤੇ ਆ ਮੀਨਸ ਦੇਖਣ ਨੂੰ ਬੜੇ ਭੱਦੇ ਬੁਰੇ ਲੱਗ ਰਹੇ ਆ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਉਹਨੂੰ ਆਪਣੇ ਘਰ ਆਪਣੀ ਕਿਚਨ 'ਚ ਉਹਨਾਂ ਨੂੰ ਰੱਖ ਸਕਦੀ ਹਾਂ ਮੈਂ ਸੈਟਿਸਫਾਈਡ ਨਹੀਂ ਹੈਗੀ ਤੁਹਾਡੀ ਇਸ ਡਿਲੀਵਰੀ ਤੋਂ ਕੀ ਤੁਸੀਂ ਇਹਨੂੰ ਇਹਨਾਂ ਨੂੰ ਵਾਪਸ ਕਰ ਸਕਦੇ ਹੋ ਪਲੀਜ਼ ਹੈ ਨਾ ਜਾਂ ਤਾਂ ਮੈਨੂੰ ਜੋ ਮੈਂ ਮੰਗਵਾਏ ਐਕਚੁਅਲ ਤੁਹਾਨੂੰ ਮੈਂ ਭੇਜੀ ਹੈ ਪਿਕਚਰ ਜਿਹੜੀ ਆ ਮੈਨੂੰ ਉਹੀ ਭੇਜੋ ਪਲੀਜ਼ ਜਾਂ ਫਿਰ ਪਲੀਜ਼ ਮੇਰਾ ਪੈਸੇ ਮੇਰੇ ਰਿਫੰਡ ਕਰੋ ਹੈ ਨਾ ਜਿੱਦਾਂ ਮਰਜ਼ੀ ਕਰੋ ਪਰ ਮੈਨੂੰ ਇਹ ਪਸੰਦ ਨਹੀਂ ਹੈ ਮੈਂ ਇਹ ਪ੍ਰੋਡਕਟ ਨਹੀਂ ਰੱਖ ਸਕਦੀ ਧੰਨਵਾਦ ਜੀ